ਹੈਲੋ ਹਾਂਜੀ ਬਿਲਕੁਲ ਠੀਕ ਠਾਕ ਤੁਹਾਡਾ ਕੀ ਹਾਲ ਚਾਲ ਹੈ ਅਤੇ ਕਿੱਥੇ ਬੈਠੇ ਹੋ ਅੱਛਿਆ ਅਤੇ ਹੋਰ ਕੀ ਲੱਗਦਾ ਤੁਹਾਨੂੰ ਅੱਜ ਕੱਲ੍ਹ ਦੇ ਬੱਚਿਆਂ ਦਾ ਟਰੈਂਡ ਕਿਹਦੇ ਵੱਲ ਜ਼ਿਆਦਾ ਰੁਝਾਨ ਹੋਇਆ ਹੈ ਹਾਂ ਨਹੀਂ ਉਹ ਗੱਲ ਤਾਂ ਠੀਕ ਹੈ ਕਿ ਆਈ ਟੀ ਸੈਕਟਰ 'ਚ ਜ਼ਿਆਦਾ ਹੈਗੀ ਹੈ ਜਾਂ ਗਰੋਥ ਹੈ ਕਾਫ਼ੀ ਪੈਸਾ ਵੀ ਹੈ ਅਤੇ ਹਾਂ ਹਾਂ ਚਲੋ ਫਿਰ ਠੀਕ ਹੈ ਸ਼ਾਮ ਨੂੰ ਮਿਲਦੇ ਹਾਂ ਅਤੇ ਇਕੱਠੇ ਚਾਹ ਪਾਣੀ ਪੀਨੇ ਹਾਂ ਅਤੇ ਨਾਲ ਇਹਦੇ ਬਾਰੇ ਵੀ ਗੱਲ ਕਰਦੇ ਹਾਂ